ਹੈਲੋ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਦੱਸੋ ਗੁਡ ਮੋਰਨਿੰਗ ਜੀ ਗੁਡ ਮੋਰਨਿੰਗ ਬਸ ਵਧੀਆ ਤੁਸੀਂ ਸੁਣਾਓ ਠੀਕ ਠਾਕ ਅੱਛਾ ਜੀ ਹਾਂਜੀ ਜੀ ਹਾਂਜੀ ਮੈਮ ਮੈਨੇ ਛੇ ਸਾਲ ਹੋ ਗਿਆ ਸੀ ਜਲੰਧਰ ਇਹਨਾਂ ਜਲੰਧਰ ਬਾਰੇ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ ਅਸੀਂ ਤਾਂ ਇੱਧਰ ਕੈਂਟ ਵਾਲੀ ਸਾਈਡ ਜਲੰਧਰ ਕੈਂਟ ਵਾਲੀ ਸਾਈਡ 'ਤੇ ਰਹਿੰਦੇ ਹਾਂ ਤੁਸੀਂ ਕਿੱਥੋਂ ਆਉਣਾ ਅੱਛਾ ਜੀ ਦਿੱਲੀ ਤੋਂ ਜਲੰਧਰ ਠੀਕ ਆ ਅੱਛਾ ਜੀ ਹਾਂਜੀ ਮੈਮ ਪੰਜਾਬ ਜਲੰਧਰ ਬਹੁਤ ਵਧੀਆ ਜਗ੍ਹਾ ਵਾ ਤੁਸੀਂ ਲੈ ਆਓ ਬੱਚਿਆਂ ਨੂੰ ਜਿੰਨਾ ਮਰਜ਼ੀ ਦਿਨ ਘੁਮਾਓ ਦੇਖ ਲਓ ਤੁਸੀਂ ਕਦੋਂ ਆਉਣ ਦਾ ਵਿਚਾਰ ਆ ਤੁਹਾਡਾ ਅੱਛਾ ਜੀ ਹਾਂਜੀ ਦੱਸੋ ਮੈਂ ਤੁਹਾਡੀ ਕੀ ਹੈਲਪ ਕਰ ਸਕਦੇ ਹਾਂਜੀ ਹਾਂਜੀ ਹਾਂਜੀ ਜਲੰਧਰ ਦੇ ਵਿੱਚ ਮੈਮ ਜੇਕਰ ਤਾਂ ਸਾਡੇ ਬੱਚੇ ਛੋਟੇ ਆ ਤਾਂ ਤੁਸੀਂ ਜਲੰਧਰ 'ਚ ਨਿੱਕੂ ਪਾਰਕ ਮਾਡਲ ਟਾਊਨ ਦੇ ਕੋਲ ਜਾਂਦੇ ਸੈਂਟਰ ਵਿੱਚ ਪੈਂਦਾ ਵਾ ਉਹਦੇ ਵਿੱਚ ਬੱਚਿਆਂ ਵਾਸਤੇ ਸਵਿੰਗ ਵੀ ਹੈ ਬੱਚਿਆਂ ਵਾਸਤੇ ਹਰ ਤਰ੍ਹਾਂ ਦੇ ਝੂਲੇ 'ਚ ਕਹਿ ਲਓ ਉੱਥੇ ਬੱਚਿਆਂ ਵਾਸਤੇ ਇੱਕ ਉਹਦੀ ਟ੍ਰੇਨ ਵੀ ਹੈ ਟਰੇਨ ਦੇ ਵਿੱਚ ਵੀ ਬੱਚੇ ਇੰਜੋਏ ਟਰੇਨ ਦੀ ਰਾਈਡ ਵੀ ਕਰ ਸਕਦੇ ਆ ਬੈਨਸ ਟਾਈਪ ਬਣੀਆਂ ਹੋਈਆਂ ਬੱਚੇ ਉਹਦੇ ਵਿੱਚੋਂ ਨਿਕਲਦੇ ਆ ਉਹ ਵੀ ਅੱਛਾ ਪਲੇਸ ਆ ਜਲੰਧਰ 'ਚ ਅਤੇ ਉਹਦੇ 'ਚ ਬੱਚਿਆਂ ਵਾਸਤੇ ਉਥੇ ਕੰਟੀਨ ਵੀ ਪ੍ਰੋਪਰ ਖਾ ਸਕਦੇ ਬਟ ਉਹਦੀਆਂ ਟਾਈਮ ਈਵਨਿੰਗ ਟਾਈਮਿੰਗਸ ਆ ਸ਼ਾਮ ਦੇ ਟਾਈਮ ਖੋਲਦਾ ਵਾ ਅਤੇ ਉਸ ਤੋਂ ਬਾਅਦ ਰਾਤ ਤੱਕ ਚਲਦਾ ਸੰਡੇ ਨੂੰ ਵੀ ਉਹ ਵੀ ਸਾਰੇ ਮਤਲਬ ਆਲ ਡੇ ਓਪਨ ਬਟ ਉਹਦਾ ਟਾਈਮਿੰਗ ਈਵਨਿੰਗ ਟਾਈਮ ਆ ਤੁਹਾਡੇ ਬੱਚੇ ਕਿੰਨੇ ਕੁ ਵੱਡੇ ਆ ਅੱਛਾ ਜੀ ਫਿਰ ਤੁਸੀਂ ਵੰਡਰਲੈਂਡ ਵੀ ਟਰਾਈ ਕਰ ਸਕਦੇ ਹੋ ਜਲੰਧਰ ਵਿੱਚ ਵੰਡਰਲੈਂਡ ਵੀ ਹੈ ਵੰਡਰਲੈਂਡ ਅਤੇ ਵੱਡਿਆਂ ਵਾਸਤੇ ਵੀ ਉਹ 'ਚ ਉਹ 'ਚ ਵੀ ਰਾਈਟਸ ਵੀ ਆ ਉਹਦੇ 'ਚ ਪ੍ਰੋਪਰ ਉਹ ਵੀ ਆ ਰੈਸਟੋਰੈਂਟ ਟਾਈਪ ਵੀ ਆ ਉੱਥੇ ਤਾਂ ਬਹੁਤ ਹੀ ਜ਼ਿਆਦਾ ਰਾਈਟ ਆ ਬਟ ਇਹ ਆ ਕਿ ਉਹ ਜਲੰਧਰ ਥੋੜ੍ਹਾ ਆਊਟਰ ਏਰੀਏ 'ਚ ਪੈਂਦਾ ਵਾ ਨਿਕੂ ਪਾਰਕ ਤਾਂ ਮਿੱਡ 'ਚ ਪੈ ਜਾਂਦਾ ਵਾ ਅਤੇ ਉਹ ਥੋੜ੍ਹਾ ਆਊਟਰ ਏਰੀਆ 'ਚ ਪੈਂਦਾ ਵਾ ਇਹ ਤੋਂ ਇਲਾਵਾ ਜੇ ਤੁਸੀਂ ਫਨ ਪਾਰਕ ਜਾਣਾ ਚਾਹੁੰਦੇ ਹੋ ਅਤੇ ਹਰਲੀਨ ਵਾਟਰ ਪਾਕ ਵੀ ਹੈ ਤਾਂ ਸਰਦੀਆਂ ਦੇ ਸੀਜ਼ਨ ਦੇ ਵਿੱਚ ਤਾਂ ਬੱਚੇ ਜਾਣਾ ਨਹੀਂ ਹਾਂ ਪਸੰਦ ਕਰੇਂਗੇ ਨਾ ਪਾਣੀ ਦਾ ਵਿੱਚ ਥੋੜ੍ਹਾ ਜਿਹਾ ਹੁੰਦਾ ਵੈਸੇ ਦੇਖਣ ਜਾਣਾ ਹੋਵੇ ਅਤੇ ਉਹਦੀ ਸਿਨਰੀ ਵੇਚੀ ਹੈ ਅਤੇ ਉੱਥੇ ਜਾ ਕੇ ਉੱਥੇ ਵੀ ਪ੍ਰੋਪਰ ਸਭ ਜਗ੍ਹਾ ਖਾਣ ਪੀਣ ਦਾ ਇੰਤਜ਼ਾਮ ਹੈਗਾ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੋਰ ਆ ਰਿਹਾ ਤੁਸੀਂ ਅਤੇ ਬੱਚੇ ਅੱਛਾ ਜੀ ਨਹੀਂ ਨਹੀਂ ਮੋਸਟ ਵੈਲਕਮ ਜੀ ਤੁਸੀਂ ਜਲੰਧਰ ਜਦੋਂ ਮਰਜ਼ੀ ਆਓ ਤੁਸੀਂ ਜਦੋਂ ਆਓਗੇ ਮੈਨੂੰ ਇੱਕ ਵਰੀ ਕਾਲ ਕਰ ਦਿਓ ਮੈਂ ਤੁਹਾਨੂੰ ਉਥੋਂ ਦੀ ਪਿੱਕ ਕਰ ਦੂੰਗੀ ਅਤੇ ਤੁਹਾਨੂੰ ਹੋਰ ਕੋਈ ਗਾਈਡੈਂਸ ਦੀ ਜ਼ਰੂਰਤ ਹੋਵੇਗੀ ਅਤੇ ਮੈਂ ਤੁਹਾਨੂੰ ਕਰਾਂਗੀ ਗੱਲ ਠੀਕ ਹੈ ਜੀ ਰਹਿਣ ਲਈ ਮੈਡਮ ਜੇ ਤੁਹਾਡੇ ਕੋਈ ਜਿੱਦਾਂ ਰਿਲੇਟਵਿਸ ਵਗੈਰਾ ਜੇ ਤੁਸੀਂ ਉੱਥੇ ਸਟੇ ਕਰਨਾ ਚਾਹੁੰਦੇ ਹੋ ਤਾਂ ਠੀਕ ਹੈ ਵੈਸੇ ਹੋਟਲ 'ਚ ਅਤੇ ਬਹੁਤ ਜ਼ਿਆਦਾ ਹੋਟਲ ਸਨ ਜਲੰਧਰ ਵਿੱਚ ਤੁਸੀਂ ਜਿੱਥੇ ਮਰਜ਼ੀ ਰਹਿਣਾ ਚਾਹੋ ਜੇ ਤੁਸੀਂ ਮਿਡ ਦੇ ਵਿੱਚ ਰਹਿਣਾ ਚਾਹੁੰਦੇ ਹੋ ਸਿਟੀ ਦੇ ਤਾਂ ਵੀ ਬਹੁਤ ਸਾਰੇ ਹੋਟਲਸ ਆ ਤਾਂ ਰੈਡੀਸਨ ਆ ਉਧਰੋਂ ਉਧਰ ਹੋਟਲ ਪਾਰਕ ਲੇਨ ਹੈਡਕੁਆਟਰ ਆ ਬਹੁਤ ਜਿਆਦਾ ਹੋਟਲਸ ਆ ਇਹ ਤੁਸੀਂ ਦੇਖਿਓ ਕਿ ਤੁਹਾਨੂੰ ਕਿੱਥੇ ਕਿੱਥੇ ਤੁਹਾਡਾ ਜਿੱਦਾਂ ਤੁਸੀਂ ਕਹਿੰਦੇ ਕੋਈ ਫਰੈਂਡ ਦੀ ਆਪਣੇ ਹਸਬੈਂਡ ਦੇ ਫਰੈਂਡ ਦੀ ਮੈਰਿਜ 'ਤੇ ਆ ਰਹੇ ਹੋ ਕਹਿ ਰਹੇ ਹੋ ਹਾਂ ਬੱਚਿਆਂ ਨੂੰ ਘੁਮਾ ਨਹੀਂ ਨਹੀਂ ਠੀਕ ਆ ਠੀਕ ਆ ਫਿਰ ਤੁਸੀਂ ਜਦੋਂ ਆਓਗੇ ਮੈਨੂੰ ਇੱਕ ਵਾਰੀ ਕਾਲ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ ਓਕੇ ਜੀ ਕੋਈ ਗੱਲ ਨਹੀਂ ਜੀ ਇਹ 'ਚ ਕੀ ਹੈ ਠੀਕ ਹੈ ਓਕੇ ਜੀ ਓਕੇ ਓਕੇ